ਮੇਰਾ ਇੱਕ ਯਾਦਗਾਰ ਚੜਾਈ ਯਾਤਰਾ ਦੀ ਗੱਲ ਕਰਾਂ ਤਾਂ ਵੈਸ਼ਨੋ ਦੇਵੀ ਬੜੀ ਇੱਕ ਸਾਡੀ ਧਾਰਮਿਕ ਮਾਨਤਾ ਰੱਖਣ ਵਾਲੀ ਇੱਕ ਜਗ੍ਹਾ ਹੈ ਜਿੱਥੇ ਅਕਸਰ ਅਸੀਂ ਸਾਰੇ ਹੀ ਜਾਂਦੇ ਕਈ ਵਾਰੀ ਤਾਂ ਕੋਈ ਨਾ ਕੋਈ ਮੰਨਤ ਮੰਗ ਕੇ ਹੀ ਜਾਂਦੇ ਹੈ ਕਈ ਵੈਸੇ ਮੱਥਾ ਟੇਕਣ ਲਈ ਜਾਂਦੇ ਹੈ ਮਾਤਾ ਦਾ ਆਸ਼ੀਰਵਾਦ ਲੈਣ ਲਈ ਕਈ ਹਰ ਸਾਲ ਹੀ ਜਾਂਦੇ ਬਲਕਿ ਅਤੇ ਚਲੋ ਮੈਨੂੰ ਇਸ ਤਰ੍ਹਾਂ ਜਾਣ ਦਾ ਜਦੋਂ ਪਹਿਲੀ ਵਾਰੀ ਮੌਕਾ ਮਿਲਿਆ ਅਤੇ ਕਿਉਂਕਿ ਮੈਨੂੰ ਇੰਨਾ ਜਾਣਕਾਰੀ ਨਹੀਂ ਸੀ ਥੋੜ੍ਹਾ ਬਹੁਤਾ ਸੁਣਿਆ ਹੋਇਆ ਸੀ ਲੇਕਿਨ ਐਕਚੁਲੀ ਉਹ ਕਿਸ ਤਰ੍ਹਾਂ ਦਾ ਹੋਏਗਾ ਚੜਾਈ ਦਾ ਐਕਸਪੀਰੀਅੰਸ ਜਾਂ ਕੀ ਹੋਏਗਾ ਉਹ ਮੈਨੂੰ ਨਹੀਂ ਪਤਾ ਅਤੇ ਮੈਂ ਕਾਫੀ ਦੇਰ ਪਹਿਲਾਂ ਗਿਆ ਉਦੋਂ ਫੈਸਿਲਟੀਆਂ ਵੀ ਕੁਛ ਇੰਨੀ ਹੈ ਨਹੀਂ ਸੀ ਅਤੇ ਇਸ ਕਰਕੇ ਮੈਂ ਉੱਥੇ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਤੁਸੀਂ ਇੱਕ ਕਰ ਸਕਦੇ ਹੋ ਘੋੜਾ ਵਗੈਰਾ ਜਾਂਦੇ ਸੀ ਉਹ ਕਹਿੰਦੇ ਤੁਸੀਂ ਉਹਨਾਂ ਦੀ ਹੈਲਪ ਲੈ ਸਕਦੇ ਹੋ ਤਾਂ ਮੈਂ ਉਸਨੂੰ ਪ੍ਰੈਫਰ ਕੀਤਾ ਕਿ ਚਲੋ ਜੇ ਇਸ ਤਰ੍ਹਾਂ ਹੋ ਸਕਦਾ ਅਤੇ ਮੈਂ ਉਹ ਘੋੜੇ 'ਤੇ ਸਵਾਰੀ ਕੀਤੀ ਉੱਥੇ ਇਸ ਚੀਜ਼ ਨੂੰ ਮੈਂ ਦੇਖਿਆ ਕਿ ਜਿਹੜੇ ਤਾਂ ਪੈਦਲ ਜਾਣ ਵਾਲੇ ਸੀ ਉਹਨਾਂ ਵਾਸਤੇ ਤਾਂ ਇਹ ਸੀਗਾ ਕਿ ਉਹ ਜ ਜਿਹੜੀ ਨੀਚੇ ਵੱਲ ਨੂੰ ਸੀਗਾ ਨੁੱਕਰ ਸੀ ਮਤਲਬ ਜਿਹੜੀ ਕਿਨਾਰੇ ਦੇ ਉੱਤੇ ਥੱਲੇ ਵੱਲ ਨੂੰ ਡਿੱਗਣ ਦਾ ਖ਼ਤਰਾ ਸੀ ਸਗੋਂ ਜਿਹੜੇ ਘੋੜੇ ਵਗੈਰਾ ਸੀ ਉਸੇ ਸਾਈਡ 'ਤੇ ਹੀ ਚੱਲਦੇ ਸੀ ਸੋ ਇਹ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਡਰ ਮਹਿਸੂਸ ਹੁੰਦਾ ਬੰਦੇ ਨੂੰ ਕਿ ਕਿਨਾਰੇ ਵੱਲ ਨੂੰ ਚੱਲਣ 'ਤੇ ਅਤੇ ਘੋੜੇ ਬਲਕਿ ਉੱਧਰ ਹੀ ਚੱਲਦੇ ਸੀ

ਮੈਂ ਉਸ ਚੀਜ਼ ਤੋਂ ਦੇਖਿਆ ਕਿ ਇਹ ਬ ਅ ਇਸਦੀ ਬਜਾਇ ਪੈਦਲ ਚੱਲਣਾ ਜ਼ਿਆਦਾ ਬੈਟਰ ਹੈ ਸੋ ਮਤਲਬ ਮੈਂ ਆਪਣੇ ਇਸ ਡਰ ਨੂੰ ਹਟਾਉਣ ਵਾਸਤੇ ਮੈਂ ਉਹ ਘੋੜੇ ਨੂੰ ਰਸਤੇ ਵਿੱਚ ਹੀ ਛੱਡ ਦਿੱਤਾ ਚਾਹੇ ਉਹਨੂੰ ਮੈਨੂੰ ਪੈਸੇ ਪੂਰੇ ਦੇਣੇ ਪਏ ਤਾਂ ਮੈਂ ਆਪਣੀ ਯਾਤਰਾ ਫਿਰ ਆਪ ਹੀ ਪੂਰੀ ਕੀਤੀ ਬਾਕੀ ਧਾਰਮਿਕ ਸਥਾਨ 'ਤੇ ਜਾਂਦੇ ਆ ਤਾਂ ਇਹ ਜ਼ਰੂਰ ਰਹਿੰਦਾ ਵਾ ਕਿ ਜਿਸ ਤਰ੍ਹਾਂ ਹੁਣ ਸਾਰੇ ਮਾਤਾ ਦਾ ਨਾਮ ਲੈਂਦੇ ਚੜਦੇ ਜਾਂਦੇ ਹੈ ਅਤੇ ਉਹ ਵੀ ਇੱਕ ਬੜਾ ਹੌਸਲੇ ਵੱਲ ਹੌਸਲਾ ਅਫਜਾਈ ਹੁੰਦੀ ਆ ਜਦੋਂ ਮਾਤਾ ਦਾ ਨਾਂ ਲੈਂਦੇ ਲੈਂਦੇ ਜਾਂਦੇ ਹਾਂ